ਹੈਲੋ ਭਾਅ ਜੀ ਓਲਾ ਤੋਂ ਬੋਲਦੇ ਪਏ ਹਾਂਜੀ ਭਾਅ ਜੀ ਮੈਂ ਨਾ ਹਰਿਮੰਦਰ ਸਾਹਿਬ ਤੱਕ ਜਾਣਾ ਸੀ ਤਾਂ ਅ ਤੁਹਾਡੇ ਕੋਲ ਕੋਈ ਗੱਡੀ ਹੋਏਗੀ ਗੱਡੀ ਮੈਨੂੰ ਦੋ ਜਾਣਿਆਂ ਲਈ ਚਾਹੀਦੀ ਹੈ ਅਤੇ ਬਿਲਕੁਲ ਕਲੀਨ ਚਾਹੀਦੀ ਹੈ ਮਤਲਬ ਕਈ ਪਸੈਂਜਰਸ ਹੁੰਦੇ ਆ ਗੰਦ ਪਾ ਜਾਂਦੇ ਜਾਂਦੇ ਫਿਰ ਤੁਸੀਂ ਉਹੀ ਭੇਜ ਦਿੰਦੇ ਜੋ ਕਈ ਵਾਰ ਅਤੇ ਮਤਲਬ ਤੁਸੀਂ ਕੱਲ੍ਹ ਸਾਢੇ ਦਸ ਦਾ ਲਾ ਲਉ ਪ੍ਰੋਗਰਾਮ ਹਾਂਜੀ ਅਤੇ ਡਰਾਈਵਰ ਵੀ ਸਹੀ ਹੋਵੇ ਡਰੰਕ ਨਾ ਹੋਵੇ ਅਤੇ ਦੂਜੀ ਗੱਲ ਜੇ ਤੁਸੀਂ ਆਟੋ ਦਾ ਅਰੇਂਜਮੈਂਟ ਕਰਾ ਸਕਦੇ ਹੋ ਤਾਂ ਉਹ ਵੀ ਵੈਲ ਐਂਡ ਗੁੱਡ ਹੋਏਗਾ ਕਿਉਂਕਿ ਲਾਗੇ ਹੀ ਹੈਗਾ ਮੇਰੇ ਹਰਿਮੰਦਰ ਸਾਹਿਬ ਅਤੇ ਆਟੋ 'ਤੇ ਵੀ ਕਿੰਨੇ ਕੁ ਪੈਸੇ ਹੋਣਗੇ ਠੀਕ ਹੈ ਥੋੜ੍ਹੇ ਜ਼ਿਆਦਾ ਨਹੀਂ ਹੈ

ਠੀਕ ਹੈ ਅਤੇ ਬੰਦਾ ਸਹੀ ਹੋਏਗਾ ਨਾ ਔਟੋ ਵਾਲਾ ਹਾਂਜੀ ਅਸੀਂ ਦੋ ਹੀ ਜਾਣੇ ਆ ਠੀਕ ਹੈ ਅਤੇ ਤੁਸੀਂ ਫਿਰ ਕੱਲ੍ਹ ਦਸ ਵਜੇ ਭੇਜ ਦਿਓ ਔਟੋ ਹਾਂਜੀ ਮੇਰਾ ਅਡਰੈਸ ਹੈਗਾ ਲਿਖੋ ਖਾਲਸਾ ਕੋਲਜ ਦੀ ਗਲੀ ਹੈਗੀ ਨਾ ਜਿਹੜੀ ਉਹਦੇ ਲਾਗੇ ਕਲੈਕਸ਼ਨ ਹੈਗੀ ਆ ਸ਼ੂਜ ਦੀ ਹਾਂਜੀ ਉਹਦੇ ਲਾਗੇ ਘਰ ਹੈ ਮੇਰਾ ਤੁਸੀਂ ਕਲੈਕਸ਼ਨ ਲਾਗੇ ਆ ਆ ਕੇ ਮੈਨੂੰ ਕੋਲ ਕਰ ਦਿਓ ਅਤੇ ਹਾਂਜੀ ਦੋ ਜਾਣੇ ਅਸੀਂ ਅਤੇ ਹਰਿਮੰਦਰ ਸਾਹਿਬ ਤੱਕ ਜਾਣਾ ਠੀਕ ਹੈ ਅਸੀਂ ਉਹਦੇ ਨਾਲ ਹੀ ਗੱਲ ਕਰ ਲਾਂਗੇ ਓਕੇ ਓਕੇ ਸਰ ਓਕੇ ਓਕੇ ਸਰ ਥੈਂਕ ਯੂ ਥੈਂਕ ਯੂ